ਹੈਲੋ ਹਾਂਜੀ ਨਮਸ਼ਕਾਰ ਜੀ

ਮੈਡਮ ਕਈ ਤਰ੍ਹਾਂ ਦੇ ਹੈਗੇ ਹੈ ਲੋਕ ਟੂਣੇ ਬਹੁਤ ਕਰਦੇ ਹੈ ਸਾਡੇ ਏਰੀਏ ਦੇ ਵਿੱਚ ਇੱਥੇ ਤੁਸੀਂ ਆਓਗੇ ਦੇਖੋਗੇ ਚੌਂਕ ਦੇ ਵਿੱਚ ਨਾਰੀਅਲ 'ਚ ਲਪੇਟ ਕੇ ਕੱਪੜੇ ਦੇ ਵਿੱਚ ਲਪੇਟ ਕੇ ਚਾਵਲ ਰੱਖ ਕੇ ਇਸ ਤਰ੍ਹਾਂ ਕਰਦੇ ਹੈ ਕਿ ਜੋ ਸਵੇਰੇ ਟੂਣਾ ਦੇਖੇਗਾ ਉਨ ਦੇ ਉਹਦਾ ਨੁਕਸਾਨ ਹੋ ਜਾਂਦਾ ਹੈ ਅਤੇ ਜੋ ਤੁਸੀਂ ਇੱਛਾ ਕੀਤੀ ਹੈ ਕਿ ਤੁਹਾਡਾ ਮਤਲਬ ਆ ਕੋਈ ਮਨੋਕਾਮਨਾ ਪੂਰੀ ਹੋਵੇ ਤਾਂ ਉਹ ਲੋਕ ਬਹੁਤ ਕਰਦੇ ਹੈ ਅਤੇ ਅਗਰ ਕੋਈ ਦੇਖ ਲਵੇ ਕਿਸੇ ਨੇ ਜ਼ਰੂਰੀ ਕੰਮ ਜਾਣਾ ਹੈ ਤਾਂ ਉਸ ਤੋਂ ਗਾਹਾਂ ਲੰਘਦੇ ਨਹੀਂ ਉੱਥੋਂ ਵਾਪਸ ਮੁੜ ਜਾਂਦੇ ਹੈ ਔਰ ਕਿੰਨੀ ਕਿੰਨੀ ਦੇਰ ਉੱਥੋਂ ਲੰਘਦੇ ਨਹੀਂ ਇਹ ਸਾਡੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਨਹੀਂ ਮੈਡਮ ਮੈਂ ਤਾਂ ਨਹੀਂ ਕਰਦਾ ਵਿਸ਼ਵਾਸ਼ ਵੁਸ਼ਵਾਸ਼ ਇਹਾ ਜਿਹਾ ਕੁਛ ਨਹੀਂ ਹੁੰਦਾ ਜੇ ਇਸ ਤਰ੍ਹਾਂ ਹੀ ਹੋਣ ਲੱਗ ਜਾਣ ਤਾਂ ਸਾਰੇ ਹੀ ਅਮੀਰ ਬਣ ਜਾਣ ਫੇਰ ਸਾਰੇ ਹੀ ਇਸ ਤਰ੍ਹਾਂ ਕਰਨ ਤਾਂ ਕੋਈ ਹੌਸਪੀਟਲ 'ਚ ਜਾਵੇ ਹੀ ਨਾ ਫੇਰ ਉਹ ਸਾਰੇ ਨਾਰੀਅਲ ਤੋੜ ਕੇ ਅਤੇ ਪਾਣੀ ਡੋਲ ਕੇ ਜਾਂ ਚਾਵਲ ਰੱਖ ਕੇ ਅਤੇ ਠੀਕ ਹੋ ਜਾਣ ਬਿਮਾਰੀਆਂ ਨਾਂ ਦੀ ਕੋਈ ਚੀਜ਼ ਹੀ ਨਾ ਹੋਵੇ ਲੇਕਿਨ ਹਸਪਤਾਲ ਤਾਂ ਭਰੇ ਪਏ ਨੇ ਬਿਮਾਰਾਂ ਨਾਲ ਹ ਕਿੰਨੀ ਗਰੀਬੀ ਹੈ ਅਤੇ ਆਪਾਂ ਦੇਖਦੇ ਹੀ ਪਏ ਹਾਂ ਤਾਂ ਇਹ ਸਭ ਕੁਛ ਆਪਦੇ ਮਨ ਨੂੰ ਤਸੱਲੀ ਦੇਣ ਵਾਲੀ ਗੱਲ ਹੈ ਮੈਂ ਤਾਂ ਇਸ 'ਤੇ ਜ਼ਿਆਦਾ ਵਿਸ਼ਵਾਸ਼ ਨਹੀਂ ਕਰਦਾ ਪਰ ਸਾਡੇ ਏਰੀਏ ਦੇ ਜਿਹੜੇ ਲੋਕ ਨੇ ਉਹ ਬਹੁਤ ਕਰਦੇ ਹੈ ਮੈਨੂੰ ਵੀ ਕਈ ਜਣੇ ਕਹਿੰਦੇ ਹੈ ਵੀ ਤੂੰ ਡਰਦਾ ਨਹੀਂ ਤੂੰ ਇਸ ਤਰ੍ਹਾਂ ਕਰ ਤੂੰ ਓਸ ਤਰ੍ਹਾਂ ਕਰ ਮੈਂ ਤਾਂ ਸਗੋਂ ਨਾਰੀਅਲ ਤੋੜ ਕੇ ਅਤੇ ਖਾ ਪੀ ਲੈਂਦਾ ਹੁੰਦਾ ਵਿੱਚੋਂ ਸਮਾਨ ਮੈਂ ਜ਼ਰਾ ਨਹੀਂ ਕਰਦਾ ਹੈਗਾ ਓਕੇ ਠੀਕ ਹੈ ਮੈਮ